ਡਾਂਸ ਕਰਨਾ ਮੈਨੂੰ ਬਹੁਤ ਹੀ ਪਸੰਦ ਹੈ ਅਤੇ ਇਹ ਇੱਕ ਬਹੁਤ ਹੀ ਵਧੀਆ ਅਤੇ ਅਨੋਖੀ ਕਲਾ ਹੈ ਮੈਂ ਇਸਨੂੰ ਆਪਣੇ ਸਕੂਲ ਦੇ ਦਿਨਾਂ ਵਿੱਚ ਸਿੱਖਿਆ ਅਤੇ ਹਰ ਸਮੇਂ ਜਦੋਂ ਵੀ ਮੈਨੂੰ ਸਮਾਂ ਮਿਲਦਾ ਸੀ ਅਤੇ ਆਪਣੇ ਬਚਪਨ ਦੇ ਵਿੱਚ ਮੈਂ ਟੀ ਵੀ ਦੇ ਅੱਗੇ ਖੜ੍ਹ ਕੇ ਭੰਗੜਾ ਕਰਦੀ ਸੀ ਡਾਂਸ ਕਰਦੀ ਸੀ ਅਤੇ ਮੈਨੂੰ ਇਹ ਬਹੁਤ ਜ਼ਿਆਦਾ ਪਸੰਦ ਸੀ ਅਤੇ ਹੁਣ ਮੈਂ ਕਾਲਜ ਦੇ ਵਿੱਚ ਆ ਕੇ ਇਸਨੂੰ ਵੱਡੇ ਪੱਧਰ 'ਤੇ ਕੀਤਾ ਅਤੇ ਇੱਕ ਵੱਡੀ ਸਟੇਜ 'ਤੇ ਮੈਂ ਜਦੋਂ ਡਾਂਸ ਕੀਤਾ ਅਤੇ ਮੈਨੂੰ ਉਸ ਟਾਈਮ ਪਹਿਲੀ ਵਾਰ ਟਰੋਫ਼ੀ ਮਿਲੀ ਅਤੇ ਨਾਲ ਦੀ ਨਾਲ ਹੁਣ ਮੈਂ ਅੰਤਰਰਾਸ਼ਟਰੀ ਡਾਂਸਰ ਵੀ ਹਾਂ ਕਿਉਂਕਿ ਮੈਨੂੰ ਡਾਂਸ ਕਰਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਜਿਸ ਕਰਕੇ ਮੇਰੇ ਇਹ ਮੇਰਾ ਇਹ ਟੇਲੈਂਟ ਦੂਜਿਆਂ ਦੇ ਸਾਹਮਣੇ ਆਉਂਦਾ ਹੈ ਅਤੇ ਜੇ ਮੈਨੂੰ ਅੱਗੇ ਮੌਕਾ ਮਿਲਦਾ ਹੈ ਤਾਂ ਮੈਂ ਪਿੱਛੇ ਨਹੀਂ ਹਟਾਂਗੀ ਅਤੇ ਡਾਂਸ ਦੇ ਆਪਣੇ ਡਾਂਸ ਦੇ ਨਾਲ ਹੀ ਅੱਗੇ ਵੱਧ ਵਧਾਂਗੀ